ਅਸੀਂ ਤਿੰਨ ਭਰਾ ਹਾਂ ਅਤੇ ਅਸੀਂ ਸਾਰੇ ਇੱਕ ਹੀ ਘਰ ਵਿੱਚ ਰਲ਼ ਮਿਲ ਕੇ ਰਹਿੰਦੇ ਹਾਂ ਮੈਂ ਖੇਤੀਬਾੜੀ ਕਰਦਾ ਹਾਂ ਅਤੇ ਦੂਸਰੇ ਮੇਰੇ ਭਰਾ ਉਹਨਾਂ ਵਿੱਚੋਂ ਇੱਕ ਨੌਕਰੀ ਕਰਦਾ ਹੈ ਅਤੇ ਇੱਕ ਭਰਾ ਦੀ ਕਰਿਆਨੇ ਦੀ ਦੁਕਾਨ ਹੈ ਜੇ ਮੈਂ ਆਪਣੇ ਸੁਭਾਅ ਦੀ ਗੱਲ ਕਰਾਂ ਤਾਂ ਮੇਰਾ ਜਿਹੜਾ ਸੁਭਾਅ ਹੈ ਉਹ ਬਹੁਤ ਠੰਡਾ ਹੈ ਮੈਨੂੰ ਜਿਹੜਾ ਜਲਦੀ ਗੁੱਸਾ ਨਹੀਂ ਆਉਂਦਾ ਅਤੇ ਮੈਂ ਜੀਵਨ ਵਿੱਚ ਕੋਈ ਵੀ ਮੁਸ਼ਕਲ ਜਾਂ ਦੁੱਖ ਆਉਂਦਾ ਹੈ ਤਾਂ ਉਸ ਨੂੰ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ਼ ਹੱਲ ਕਰਦਾ ਹਾਂ ਅਤੇ ਮੇਰੇ ਜਿਹੜੇ ਦੂਸਰੇ ਭਰਾ ਹਨ ਉਹਨਾਂ ਦਾ ਸੁਭਾਅ ਥੋੜ੍ਹਾ ਅਲੱਗ ਹੈ ਉਹਨਾਂ ਵਿੱਚੋਂ ਇੱਕ ਬਹੁਤ ਜਜ਼ਬਾਤੀ ਕਿਸਮ ਦਾ ਹੈ ਜਲਦੀ ਹੀ ਛੋਟੀ ਛੋਟੀ ਗੱਲ 'ਤੇ ਘਬਰਾ ਜਾਂਦਾ ਹੈ ਅਤੇ ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਤੀਸਰਾ ਭਰਾ ਮੇਰਾ ਜਲਦੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਛੋਟੀ ਜਿਹੀ ਗੱਲ 'ਤੇ ਹੀ ਗੁੱਸੇ ਹੋ ਜਾਂਦਾ ਹੈ ਅਤੇ ਸਾਡਾ ਸਾਰਿਆਂ ਭਰਾਵਾਂ ਦਾ ਸੁਭਾਅ ਅਲੱਗ ਅਲੱਗ ਹੈ